ਮੈਂ ਸਿਮਰਨ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਮੈਂ ਕਾਫ਼ੀ ਸਮੇਂ ਤੋਂ ਸਿਲਾਈ ਅਤੇ ਬੁਣਾਈ ਕਰ ਰਹੀ ਹਾਂ ਸੋ ਇੱਕ ਵਾਰ ਮੈਂ ਰੈਡੀਮੇਟ ਗਲੇ ਵਾਲਾ ਸੂਟ ਲਿਆਂਦਾ ਸੀ ਜਦੋਂ ਮੈਂ ਕੱਟ ਰਹੀ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਗਲੇ ਦੀ ਕਟਿੰਗ ਵਿੱਚ ਕਾਫ਼ੀ ਕਾਣ ਸੀ ਜਿਸ ਨੂੰ ਸੈੱਟ ਕਰਨ ਜਿਸ ਨੂੰ ਸੈੱਟ ਕਰਨਾ ਮੇਰੀ ਲਈ ਇੱਕ ਚੁਣੌਤੀ ਭਰਿਆ ਕੰਮ ਸੀ ਇਸ ਅਨੁਭਵ ਤੋਂ ਮੈਂ ਇਹ ਸਿੱਖਿਆ ਕਿ ਕੱਪੜਾ ਲੈਂਦੇ ਸਮੇਂ ਸੈਮੀ ਸਟਿਚ ਸੂਟ ਨਹੀਂ ਲੈਣੇ ਚਾਹੀਦੇ ਕਿਉਂਕਿ ਇਹਨਾਂ ਦੀ ਸਿਲਾਈ ਕਰਦੇ ਸਮੇਂ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਸਮੇਂ ਵੀ ਕਾਫ਼ੀ ਜੋ ਜਿਸ ਵਿੱਚ ਸਮੇਂ ਵੀ ਕਾਫ਼ੀ ਖਰਾਬ ਹੁੰਦਾ ਹੈ ਅਤੇ ਕੱਪੜੇ ਦੀ ਫਿਟਿੰਗ ਵੀ ਸਹੀ ਨਹੀਂ ਆਉਂਦੀ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਅਨੁਭਵ ਮੇਰੇ ਲਈ ਕਾਫ਼ੀ ਅਨੁਭਵ ਭਰਿਆ ਰਿਹਾ ਸੀ ਸੋ ਜਦੋਂ ਅਸੀਂ ਕੱਪੜਾ ਲੈਣ ਜਾਂਦੇ ਹਾਂ ਤਾਂ ਸਾਰਾ ਕੱਪੜਾ ਅਸੀਂ ਖੋਲ੍ਹ ਕੇ ਨਹੀਂ ਦੇਖ ਪਾਉਂਦੇ ਇਸ ਤਰ੍ਹਾਂ ਇਸ ਤਰ੍ਹਾਂ ਖੋਲ੍ਹ ਕੇ ਨਹੀਂ ਦੇਖ ਪਾਉਂਦੇ ਤੇ ਸੋ ਕਈ ਵਾਰ ਕਈ ਕੱਪੜਿਆਂ ਦੇ ਵਿੱਚ ਬਹੁਤ ਕਾਣ ਨਿਕਲ ਆਉਂਦੀ ਹੈ ਕਈ ਕੱਪੜਿਆਂ ਦੇ ਵਿੱਚ ਟੁੱਕ ਨਿਕਲ ਆਉਂਦੀ ਹੈ ਜਿਸ ਕਰਕੇ ਸਾਨੂੰ ਉਹ ਕੱਪੜੇ ਨੂੰ ਸੈੱਟ ਕਰਨਾ ਜਾਂ ਸਟਿਚ ਕਰਨਾ ਬੜਾ ਔਖਾ ਹੋ ਜਾਂਦਾ ਆ ਬੜਾ ਚੁੱਣੌਤੀ ਭਰਿਆ ਕੰਮ ਹੋ ਜਾਂਦਾ ਆ ਇਸ ਲਈ ਜਦੋਂ ਵੀ ਕੱਪੜਾ ਖਰੀਦੋ ਦੇਖ ਕੇ ਖਰੀਦੋ ਤਾਂ ਜੋ ਕੱਪੜਾ ਸਟਿਚ ਕਰਨ ਲੱਗਿਆਂ ਕੋਈ ਪ੍ਰੋਬਲਮ ਨਾ ਆਵੇ